ਬਿਜਲੀ ਕੱਟ ਦ ਦੀ ਸਮੱਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ ਇਹ ਸਮੱਸਿਆ ਇਕੱਲੇ ਇੱਕ ਕਿਸੇ ਪ੍ਰਾਂਤ ਦੀ ਨਹੀਂ ਹੈ ਇਹ ਪੂਰੇ ਵਿਸ਼ਵ ਵਿੱਚ ਅੱਜ ਇੱਕ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰ ਰਹੀ ਹੈ ਜੇ ਗੱਲ ਕਰੀਏ ਅਸੀਂ ਇਸ ਦੇ ਵਿਕਲਪਾਂ ਦੀ ਤਾਂ ਉਹ ਬਹੁਤ ਕੋਈ ਹੈ ਨਹੀਂ ਨਾ ਅਤੇ ਜੇ ਹੈ ਵੀ ਨੇ ਤਾਂ ਬਹੁਤ ਬਹੁਤ ਸਾਰੇ ਲੋਕ ਉਸ ਨੂੰ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਇੱਕ ਇਨਵਰਟਰ ਉਹਦੀ ਸਭ ਤੋਂ ਵੱਡੀ ਵਿਕਲਪ ਦੇ ਤੌਰ 'ਤੇ ਮੰਨਿਆ ਜਾਂਦਾ ਹੈ ਲੇਕਿਨ ਇਨਵਰਟਰ ਜਿਹੜਾ ਹੈ ਉਹ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਆਮ ਬੰਦਿਆਂ ਦੇ ਲਈ ਅੱਜ ਵੀ ਮੋਮਬੱਤੀਆਂ ਜਾਂ ਦੀਵੇ ਜਿਹੜੇ ਨੇ ਉਹ ਵਿਕਲਪ ਦੇ ਬਿਜਲੀ ਦੇ ਵਿਕਲਪ ਦੇ ਤੌਰ 'ਤੇ ਯੂਜ ਕੀਤੇ ਜਾਂਦੇ ਨੇ ਅੱਜ ਵੀ ਅਤੇ ਇਹ ਜਿਹੜੀ ਸਮੱਸਿਆ ਦਿਨ ਬ ਦਿਨ ਗਹਿਰੀ ਹੁੰਦੀ ਜਾ ਰਹੀ ਹੈ ਇਸ ਲਈ ਬਹੁਤ ਜ਼ਰੂਰੀ ਹੈ ਕਿ ਇਸ ਦੇ ਵਿਕਲਪ ਹੋਰ ਵੀ ਤਲਾਸ਼ੇ ਜਾਣ ਤਾਂ ਕਿ ਜੋ ਆਮ ਬੰਦਿਆਂ ਦੀ ਪਹੁੰਚ ਉੱਥੇ ਤੱਕ ਹੋ ਸਕੇ ਕਿਉਂਕਿ ਜਿਹੜੇ ਇਹਦੇ ਵਿਕਲਪ ਨੇ ਉਹ ਬਹੁਤ ਮਹਿੰਗੇ ਨੇ ਧੰਨਵਾਦ